ਭਾਰਤ ਦੀ ਰਾਜਨੀਤੀ ਅਤੇ ਸਿਆਸੀ ਪਾਰਟੀਆਂ ਬਾਰੇ ਮੇਰੀ ਸੋਚ ਆ ਰਾਜਨੀਤੀ ਸਿਆਸੀ ਪਾਰਟੀਆਂ ਕੋਈ ਮਾੜੀਆਂ ਨਹੀਂ ਹੁੰਦੀਆਂ ਬਟ ਇਹਦੇ ਵਿੱਚ ਕੁਛ ਕੁਝ ਵਰਕਰ ਜਿਸ ਤਰ੍ਹਾਂ ਕੰਮ ਕਰਨ ਵਾਲੇ ਨੇਤਾ ਹੁੰਦੇ ਨੇ ਜਿਸ ਤਰ੍ਹਾਂ ਉਹ ਜ਼ਿਆਦਾ ਭ੍ਰਿਸ਼ਟਾਚਾਰ ਨੂੰ ਅਪਣਾ ਲੈਂਦੇ ਨੇ ਠੀਕ ਹੈ ਜੀ ਭ੍ਰਿਸ਼ਟਾਚਾਰ ਨਾ ਹੋਵੇ ਅਤੇ ਸਾਰੀਆਂ ਪਾਰਟੀਆਂ ਵੀ ਚੰਗੀਆਂ ਨੇ ਅਤੇ ਰਾਜਨੀਤੀ ਵੀ ਚੰਗੀ ਲੱਗੂ ਸਭ ਨੂੰ ਬਾਕੀ ਭਾਰਤ ਦੇ ਲੋਕਤੰਤਰ ਵਿੱਚ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਆ ਕਿ ਇੱਥੇ ਸੜਕਾਂ ਦਾ ਵਿਕਾਸ ਹੋਇਆ ਹੈ ਪੁਲਾਂ ਦਾ ਵਿਕਾਸ ਹੋਇਆ ਹੈ ਜੋ ਉਹ ਚੀਜ਼ ਮੈਨੂੰ ਬਹੁਤ ਵਧੀਆ ਲੱਗਦੀ ਕਿਸ ਵੀ ਖੇਤਰ ਵਿੱਚ ਤੁਸੀਂ ਜਾਣਾ ਆਪਣੇ ਸਟੇਟ ਦੇ ਅਤੇ ਤੁਹਾਨੂੰ ਆਉਣ ਜਾਣ ਦੀ ਮੁਸ਼ਕਿਲ ਨਹੀਂ ਕੋਈ ਆਉਂਦੀ ਨਾ ਪਸੰਦ ਵਾਲੀ ਇਹ ਚੀਜ਼ ਆ ਕਿ ਸਾਡੇ ਜਿਹੜੇ ਦੇਸ਼ ਵਿੱਚ ਇੱਥੇ ਇੱਕ ਬੇਰੁਜ਼ਗਾਰੀ ਖਤਮ ਹੀ ਨਹੀਂ ਹੋਈ ਇੰਨੀਆਂ ਮਹਿੰਗੀਆਂ ਪੜ੍ਹਾਈਆਂ ਕਰਕੇ ਵੀ ਅਸੀਂ ਵਿਹਲੇ ਤੁਰੇ ਫਿਰਦੇ ਹਾਂ ਇਹ ਸਾਨੂੰ ਬੇਰੁਜ਼ਗਾਰੀ ਖਤਮ ਕਰਨੀ ਚਾਹੀਦੀ ਆ ਅਤੇ ਮੇਰਾ ਜਿਹੜਾ ਪ ਪਸੰਦੀਦਾ ਨੇਤਾ ਹੁੰਦਾ ਸੀ ਰਾਜਨੀਤਿਕ ਮੇਰਾ ਪਸੰਦੀਦਾ ਨੇਤਾ ਸਾਡੇ ਹੈਗੇ ਸੀ ਐੱਮ ਐੱਲ ਏ ਡਾਕਟਰ ਧਰਮਵੀਰ ਸਿੰਘ ਅਗਨੀਹੋਤਰੀ ਜਿਨ੍ਹਾਂ ਨੇ ਪਿੰਡਾਂ ਵਿੱਚ ਬਹੁਤ ਵਧੀਆ ਵਿਕਾਸ ਕੀਤਾ ਸੀ ਪਿੰਡਾਂ ਵਿੱਚ ਲਾਈਟਾਂ ਦੇ ਪ੍ਰਬੰਧ ਕਰਤੇ ਸ਼ਹਿਰਾਂ ਵਾਂਗੂੰ ਟਾਈਲਾਂ ਲਵਾਤੀਆਂ ਅਤੇ ਜੇ ਉਹ ਮੈਨੂੰ ਹੁਣ ਕਿਤੇ ਮਿਲਣਗੇ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਅਤੇ ਮੈਂ ਉਹਨਾਂ ਨੂੰ ਸਾਡੇ ਖੇਤਰ ਪਿੰਡ ਵਿੱਚ ਇੱਕ ਸਭ ਤੋਂ ਜ਼ਿਆਦਾ ਮੁਸ਼ਕਿਲ ਆਉਂਦੀ ਆ ਇਹ ਪਾਣੀ ਦੇ ਨਿਕਾਸ ਦੀ ਅਤੇ ਉਹਨਾਂ ਨੂੰ ਮੈਂ ਪਾਣੀ ਦੇ ਨਿਕਾਸ ਬਾਰੇ ਪੁੱਛਾਂਗਾ